ਲਿਖਣ ਲਈ ਸਾਫ਼ ਲਕਸ਼ ਹੋਣਾ ਚਾਹੀਦਾ ਜਿਹਦੇ ਵਿੱਚ ਪਹਿਲਾਂ ਅਸੀਂ ਇਹ ਸਮਝਦੇ ਹਾਂ ਕਿ ਲੇਖ ਅਤੇ ਆਪਣੇ ਉੱਤਰ ਦਾ ਮੁੱਖ ਉਦੇਸ਼ ਕੀ ਹੈ ਮੁੱਖ ਵਿਚਾਰਾਂ ਨੂੰ ਨੋਟ ਕਰਕੇ ਢਾਂਚਾ ਤਿਆਰ ਕਰਦਾ ਮਾਹੌਲ ਸ਼ਾਂਤ ਹੋਣਾ ਚਾਹੀਦਾ ਹੈ ਅਤੇ ਜਿੱਥੇ ਆਪਾਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਧਿਆਨ ਭਟਕਣ ਤੋਂ ਬਚਣ ਲਈ ਫੋਨ ਦੇ ਨੋਟੀਫਿਕੇਸ਼ਨਸ ਬੰਦ ਕਰਦਾ ਹਾਂ ਟਾਈਮ ਲੋਕਿੰਗ ਕਰਦਾ ਕਿ ਇਹ ਕੰਮ ਕਿੰਨੇ ਦੇਰ ਵਿੱਚ ਪੂਰਾ ਕਰਕੇ ਹੀ ਉੱਠਣਾ ਛੋਟੇ ਛੋਟੇ ਆਰਾਮ ਲਈ ਸਮਾਂ ਰੱਖਦਾ ਹਾਂ ਲਿਖਣ ਦਾ ਅੰਦਾਜ਼ ਵੀ ਬਹੁਤ ਮਾਇਨੇ ਰੱਖਦਾ ਹੈ ਕਿ ਜਿੱਦਾਂ ਕੋਈ ਡ ਡਾਇਰੀਆਂ ਲਿਖਦਾ ਹਾਂ ਜਿਵੇਂ ਜਿਹਦੇ ਵਿੱਚ ਕੁਝ ਨਿਜੀ ਵਿਸ਼ਾ ਹੋਵੇ ਜਾਂ ਫਿਰ ਦਿਨ ਦੀਆਂ ਗੱਲਾਂ ਜੋ ਕੀ ਦਿਨ ਵੀ ਸਾਡੇ ਨਾਲ ਬੀਤਿਆ ਅੱਜ ਰਸਾਲਾ ਜਾ ਸਾਜ ਸਵਾਰ ਵੀ ਲਿਖਦਾ ਹਾਂ ਦੋਨਾਂ ਵਿੱਚ ਜਿੱਦਾਂ ਕਹਾਣੀਆਂ ਅਤੇ ਰਚਨਾਤਮਿਕ ਲਿਖਾਈ ਵਰਤਦਾ ਹਾਂ ਆਮ ਤੌਰ 'ਤੇ ਭਾਸ਼ਾਵਾਂ ਮੈਂ ਪੰਜਾਬੀ ਹੋ ਗਿਆ ਅੰਗਰੇਜ਼ੀ ਹਿੰਦੀ ਦੀ ਵਰਤੋਂ ਕਰਦਾ ਹਾਂ ਧਿਆਨ ਆਪਣਾ ਮੈਂ ਕੇਂਦਰ ਰੱਖਣ ਲਈ ਧਿਆਨ ਦੇ ਅਭਿਆਸ ਕਰਦਾ ਹਾਂ ਅਤੇ ਪੰਜ ਪੰਜ ਮਿੰਟ ਦਾ ਬਰੇਕ ਵਿੱਚ ਲੈਂਦਾ ਹਾਂ ਫੀਡਬੈਕ ਲੈਣਾ ਆਪਣੇ ਸਾਥੀਆਂ ਕੋਲ ਬਾਰ ਬਾਰ ਖੁਦ ਵੀ ਉਹਨੂੰ ਆਪ ਵੀ ਉਹਨੂੰ ਦੁਬਾਰਾ ਪੜ੍ਹਨਾ ਅਤੇ ਗਲਤੀ ਨੂੰ ਠੀਕ ਕਰਦਾ ਹਾਂ ਅਤੇ ਆਪਣੇ ਦੋਸਤਾਂ ਕੋਲੋਂ ਸੁਝਾਅ ਲੈਂਦਾ ਆ ਕਿ ਇਹਨਾਂ ਵਿੱਚ ਹੋਰ ਕੀ ਕੀਤਾ ਜਾ ਸਕਦਾ ਹੈ ਅਤੇ ਸੂਚਨਾਵਾਂ ਸਭ ਲਈ ਵੱਖ ਵੱਖ ਹੋ ਸਕਦੀਆਂ ਹਨ